ਅਤੇ ਅਪਰਾਧ ਜਿਹੜੇ ਨਵ ਨਵੇਂ ਬੱਚੇ ਹੁੰਦੇ ਨੇ ਹੈਗੇ ਉਹ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਹੈਗੇ ਕੁਝ ਨਸ਼ੇ ਕਰਕੇ ਨਸ਼ੇ ਦੇ ਦੌਰਾਨ ਜਦੋਂ ਉਹ ਨਸ਼ਾ ਕਰ ਲੈਂਦੇ ਨੇ ਉਦੂੰ ਬਾਅਦ 'ਚੋਂ ਆਪਸ ਦੇ ਵਿੱਚ ਹੀ ਲੜ ਲੜਾਈਆਂ ਲੜਾਈ ਝਗੜੇ ਕਰਦੇ ਨੇ ਅਤੇ ਸਮਾਜਿਕ ਅਸ਼ਾਂਤੀ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਰਾਜਨੀਤਿਕ ਮਾਮਲਿਆਂ ਦੇ ਵਿੱਚ ਹਰੇਕ ਪੇਂਡੂ ਖੇਤਰਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਗੁੱਟ ਹੈਗੇ ਦਲ ਨੇ ਉਹ ਬਣ ਬਣ ਜਾਂਦੇ ਨੇ ਠੀਕ ਹੈ ਰਾਜਨੀਤਿਕ ਹਾਲਾਤ ਵੀ ਬਹੁਤ ਮਾੜੇ ਹੈਗੇ ਪੇਂਡੂ ਖੇਤਰਾਂ ਦੇ ਵਿੱਚ ਸਰਕਾਰੀ ਸ਼ਾਸਨਾਂ ਦੇ ਬਹੁਤ ਮਾੜੇ ਹਾਲਾਤ ਨੇ